ਮੇਰੇ ਜੀਵਨ ਕਾਲ ਦੌਰਾਨ ਸਭ ਤੋਂ ਬੜੀ ਤਬਦੀ ਤਕਨੋਲਜੀ ਤਬਦੀਲੀ ਆਈ ਹੈ ਉਹ ਹੈ ਔਨਲਾਈਨ ਸਿਸਟਮ ਔਨਲਾਈਨ ਸਿਸਟਮ ਨ ਇੰਟਰਨੈਟ ਆਉਣ ਦੇ ਨਾਲ ਜਿਹੜਾ ਆਪਾਂ ਬੈਂਕਾਂ ਦਾ ਕੰਮ ਜਿਵੇਂ ਬੈਂਕਾਂ ਦਾ ਕੰਮ ਸੀਗਾ ਔਨਲਾਈਨ ਘਰ ਬੈਠ ਕੇ ਕਰ ਸਕਦੇ ਲਾਇਨਾਂ ਵਾਲਾ ਸਿਸਟਮ ਖਤਮ ਹੋ ਗਿਆ ਜੀ ਕੋਈ ਵੀ ਕਿਸੇ ਵੀ ਤਰੀਕੇ ਦਾ ਕੰਮ ਕੋਈ ਵੀ ਔਡਰ ਦੇਣਾ ਕਿਸੇ ਦੀ ਫੀਸ ਕਟਵਾਉਣੀ ਸਾਰਾ ਅੱਜ ਅੱਜ ਦੇ ਸਮੇਂ ਆਪਾਂ ਘਰਾਂ ਬੈਠ ਕੇ ਕਰ ਸਕਦੇ ਹਾਂ ਜੀ ਪਹਿਲਾਂ ਆਪਾਂ ਇਸ ਇਹ ਹੋਣ ਨਾਲ ਸਾਡਾ ਸਮਾਂ ਪੈਸੇ ਦੋਵਾਂ ਦੀ ਬੱਚਤ ਹੋਈ ਹੈ